ਵੈਸੇ ਤਾਂ ਮੈਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਹੈਗਾ ਏ ਕਿਉਂ ਘੁੰਮਣਾ ਫਿਰਨਾ ਸਾਰਿਆਂ ਨੂੰ ਹੀ ਵਧੀਆ ਲੱਗਦਾ ਹੈਗਾ ਏ ਪਰ ਮੈਨੂੰ ਜਿੱਦਾਂ ਹੁਣ ਮੇਰੀ ਉਮਰ ਹੋ ਗਈ ਹੈਗੀ ਹੈ ਸੱਠ ਪੈਂਹਠ ਸਾਲ ਤੋਂ ਪਲੱਸ ਤਾਂ ਮੇਰੀ ਉਮਰ ਹੋ ਗਈ ਵੀ ਆ ਹੁਣ ਉਹ ਤੋਂ ਬਾਅਦ ਮੈਂ ਕਾਫੀ ਸਮਾਂ ਉਹਦੇ ਵਿੱਚੋ ਜਾਂ ਕੋਈ ਇਟਲੀ ਵੀ ਰਹਿ ਕੇ ਆਇਆ ਮੈਂ ਹੁਣ ਜਿੱਦਾਂ ਹੁਣ ਮੈਂ ਆਪਣੀ ਏਜ਼ ਦੇ ਅਕੋਡਿੰਗ ਮੈਨੂੰ ਧਾਰਮਿਕ ਜਗ੍ਹਾ 'ਤੇ ਘੁੰਮਣਾ ਬੜਾ ਚੰਗਾ ਲੱਗਦਾ ਹੈਗਾ ਜਦੋਂ ਮੈਨੂੰ ਇਟਲੀ ਤੋਂ ਆਇਆ ਉੱਥੋਂ ਆ ਕੇ ਮੈਂ ਜਿਹੜੇ ਆਪਣੇ ਸਿੱਖ ਧਰਮ ਨਾਲ ਸੰਬੰਧਿਤ ਸੀਗੇ ਪੰਜ ਤਖਤ ਉਹਨਾਂ ਦੇ ਮੈਂ ਪੰਜਾਂ ਤਖਤਾਂ 'ਤੇ ਗਿਆ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਮੈਂ ਕੇਸਗੜ੍ਹ ਸਾਹਿਬ ਤੋਂ ਯਾਤਰਾ ਸ਼ੁਰੂ ਕੀਤੀ ਕੇਸਗੜ੍ਹ ਸਾਹਿਬ ਮੱਥਾ ਟੇਕਿਆ ਕੀਰਤਪੁਰ ਸਾਹਿਬ ਗਿਆ ਉਹ ਤੋਂ ਬਾਅਦ ਦਰਬਾਰ ਸਾਹਿਬ ਅੰਮ੍ਰਿਤਸਰ ਗਿਆ ਮੈਂ ਫਿਰ ਜਿਹੜੇ ਪੰਜਾਬ ਦੇ ਜਿ ਜਿਹੜੇ ਇਹ ਤੋਂ ਇਲਾਵਾ ਦੋ ਹੋਰ ਤਖਤ ਆ ਉੱਥੇ ਗਿਆ ਪਟਨਾ ਸਾਹਿਬ ਗਿਆ ਅਤੇ ਨਾਂਦੇੜ ਸਾਹਿਬ ਵੀ ਗਿਆ ਮੈ ਅਤੇ ਇਹ ਤੋਂ ਇਲਾਵਾ ਜਿੱਦਾਂ ਹੁਣ ਮੈਂ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਜਿਹੜਾ ਅਨੰਦਪੁਰ ਸਾਹਿਬ ਹੈਗਾ ਇੱਥੇ ਸਾਡੇ ਇਹ ਸਾਡੇ ਜਿੱਦਾਂ ਨੌਵੇਂ ਗੁਰੂ ਹੈਗੇ ਸੀਗੇ ਨੌਵੇਂ ਗੁਰੂ ਨੇ ਜਿਹੜੇ ਰਾਜਾ ਉੱਥੇ ਦਾ ਸੀਗਾ ਉੱਥੇ ਦਾ ਬਸੋਲੀ ਦਾ ਰਾਜਾ ਸੀਗਾ ਭੀਮ ਚੰਦ ਉਹਨਾਂ ਤੋਂ ਉਹਨਾਂ ਨੇ ਜ਼ਮੀਨ ਲਈ ਸੀਗੀ ਉਹਨਾਂ ਤੋਂ ਜ਼ਮੀਨ ਲੈ ਕੇ ਉਹਨਾਂ ਨੇ ਉੱਥੇ ਅਨੰਦਪੁਰ ਸਾਹਿਬ ਦਾ ਉੱਥੇ ਨਗਰ ਵਸਾਇਆ ਸੀਗਾ ਅਤੇ ਉੱਥੇ ਉਹਨਾਂ ਨੇ ਉੱਥੇ ਦੇ ਹਾਥ ਜਿਹੜੇ ਕਾਰੀਗਰ ਵਗੈਰਾ ਹੈਗੇ ਤੇ ਉਹਨਾਂ ਨੂੰ ਵੀ ਉੱਥੇ ਵਸਾਇਆ ਸੀਗਾ ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੋ ਕਿ ਸਿੱਖਾਂ ਨੇ ਦਸਵੇਂ ਗੁਰੂ ਹੋਏ ਸਨ ਉਹਨਾਂ ਨੇ ਆਪਣੇ ਜੀਵਨ ਦੇ ਪੱਚੀ ਸਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਤਾਏ ਸਨ ਉਹ ਤੋਂ ਬਾ ਇਲਾਵਾ ਜਿੱਦਾਂ ਉਹ ਤੋਂ ਬਾਅਦ ਮੈਂ ਕੀਰਤਪੁਰ ਸਾਹਿਬ ਗਿਆ ਕੀਰਤਪੁਰ ਸਾਹਿਬ ਵਿਖੇ ਸਾਡੇ ਜਿਹੜੇ ਛੇਵੇਂ ਗੁਰੂ ਅਤੇ ਸੱਤਵੇਂ ਗੁਰੂ ਇਹ ਸਾਡੇ ਉਹਨਾਂ ਦਾ ਛ ਸੱਤਵੇਂ ਗੁਰੂ ਦਾ ਸ਼ਹੀਦੀ ਸਥਾ ਸ਼ਹੀਦੀ ਸਥਾਨ ਜੋਤੀ ਜੋਤ ਸਥਾਨ ਅਤੇ ਸੱ ਅਤੇ ਛੇਵੇਂ ਗੁਰੂ ਦਾ ਵੀ ਜੋਤੀ ਜੋਤ ਸਥਾਨ ਇਕ ਹੀ ਹੈਗਾ ਇੱਥੇ ਇੱਕ ਛੇਵੇਂ ਗੁਰੂ ਨਾਲ ਸੰਬੰਧਿਤ ਅਤੇ ਸੱਤ ਸੱਤਵੇਂ ਗੁਰੂ ਨਾਲ ਸੰਬੰਧਿਤ ਇੱਥੇ ਗੁਰਦੁਆਰੇ ਵੀ ਮਿਲਦੇ ਹੈਗੇ ਹੈ ਉੁਹ ਤੋਂ ਇਲਾਵਾ ਮੈਂ ਉੁਹ ਤੋਂ ਬਾਅਦ ਗਿਆ ਮੈਂ ਦਰਬਾਰ ਸਾਹਿਬ ਦਰਬਾਰ ਸਾਹਿਬ ਜਿੱਦਾਂ ਹੁਣ ਆਪਾਂ ਸਾਡਾ ਕੋਈ ਵੀ ਜਿਹੜਾ ਪੰਜਾਬੀ ਹੈ ਕਿਤੇ ਵੀ ਅ ਵਰਲਡ 'ਚ ਕਿਤੇ ਵੀ ਰਹਿੰਦਾ ਹੈਗਾ ਏ ਉਹਦੇ ਦਿਲ ਵਿੱਚ ਇੱਕੋ ਇੱਕ ਰੀਝ ਹੁੰਦੀ ਹੈਗੀ ਹੈ ਵੀ ਮੈਂ ਆਪਣੇ ਮਤਲਬ ਆਖਰੀ ਸਾਹਾਂ 'ਤੇ ਮੈਂ ਕਦੇ ਵੀ ਜ ਆਖਰੀ ਸਾਹਾਂ 'ਤੇ ਅ ਮਤਲਬ ਸਾਹਾਂ ਤੋਂ ਪਹਿਲਾਂ ਜਾਂ ਫਿਰ ਜਦੋਂ ਵੀ ਪੰਜਾਬ ਆਵਾਂ ਤਾਂ ਉਹਦੇ ਦਿਲ ਵਿੱਚ ਇੱਕੋ ਇੱਕ ਰੀਝ ਹੁੰਦੀ ਹੈ ਕਿ ਮੈਂ ਦਰਬਾਰ ਸਾਹਿਬ ਜਿਸ ਨੂੰ ਗੋਲਡਨ ਟੈਂਪਲ ਵੀ ਕਿਹਾ ਜਾਂਦਾ ਉਹਦੇ ਦਰਸ਼ਨ ਜ਼ਰੂਰ ਕੀਤੇ ਜਾਣ ਉਹ ਹੈਗਾ ਸੀਗਾ ਜਿਹੜਾ ਦਰਬਾਰ ਸਾਹਿਬ ਹੈਗਾ ਏ ਉਹ ਸ਼੍ਰੀ ਗੁਰੂ ਰਾਮਦਾਸ ਜੀ ਨੇ ਇੱਥੇ ਦ੍ਰ ਚੱ ਵਸਾਇਆ ਸੀਗਾ ਇੱਥੇ ਨਗਰ ਇਹਨਾਂ ਦੇ ਜਿਹੜੇ ਇੱਥੇ ਇੱਕ ਸਰੋਵਰ ਹੈਗਾ ਸਰੋਵਰ ਦੇ ਗੱਬੇ ਇੱਕ ਸਰੋਵਰ ਦੇ ਗੱਬੇ ਗੁਰਦੁਆਰਾ ਸਾਹਿਬ ਹੈ ਇੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਂਦਾ ਹੈਗਾ ਏ ਉਹ ਇੱਥੇ ਜਿਹੜਾ ਜਿਹੜੀਆਂ ਜਿੱਥੇ ਹੁਣ ਜਿਹੜਾ ਸਰੋਵਰ ਦੇ ਗੱਬੇ ਗੁਰਦੁਆਰਾ ਹੈਗਾ ਏ ਇੱਥੇ ਜਿਹੜਾ ਹੈਗਾ ਇਹਨਾਂ ਦੇ ਜਿਹੜਾ ਗੁਰਦੁਆਰੇ 'ਤੇ ਜਿਹੜੀਆਂ ਇੱਥੇ ਪਲੇਟਾਂ ਏ ਉਹ ਸਾਰੀਆਂ ਉਹ 'ਤੇ ਅੱਗਾ ਸੋਨੇ ਦਾ ਬਣਿਆ ਹੋਇਆ ਏ ਜਿਹੜਾ ਇੱਥੇ ਜਿਹੜੇ ਸੋਨੇ ਦੀਆਂ ਪਰਤਾਂ ਸੀਗੀਆਂ ਉਹ ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਦੀ ਸੱਸ ਸਦਾ ਕੌਰ ਉਹਨਾਂ ਨੇ ਇੱਥੇ ਸੋਨਾ ਦਾਨ ਕੀਤਾ ਸੀਗਾ ਇੱਥੇ ਉਹਨਾਂ ਦੇ ਜਿਹੜੇ ਸੋਨਾ ਦਾਨ ਕੀਤਾ ਸੀਗਾ ਉਹ ਇੱਥੇ ਜਿਹੜਾ ਹੈਗਾ ਸੀ ਉਹ ਉਹ ਪਿਘਲਾ ਕੇ ਕਿਸ ਤਰ੍ਹਾਂ ਉਹਨੂੰ ਢਾਲ ਕੇ ਉਹ ਉੱਥੇ ਦੀਆਂ ਦੀਵਾਰਾਂ 'ਤੇ ਉਹਨੂੰ ਲਗਾਇਆ ਗਿਆ ਸਾਰਾ ਕਿਤੇ ਉਹਨੂੰ ਉਹ ਤੋਂ ਉੱਥੋਂ ਤੋਂ ਉਹ ਜਦ ਇਹ ਇੱਥੋਂ ਹੀ ਮਤਲਬ ਦੀਵਾਰਾਂ 'ਤੇ ਹੁਣ ਤੱਕ ਵੀ ਇੱਥੇ ਹੀ ਲੱਗਿਆ ਹੋਇਆ ਹੈਗਾ ਏ ਇਹ ਤੋਂ ਇਲਾਵਾ ਮੈਂ ਹੋਰ ਵੀ ਕਈ ਥਾਵਾਂ 'ਤੇ ਗਿਆ